ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਮੈਂ ਦੱਸਦੀ ਹਾਂ ਇੱਕ ਸੈਕਿੰਡ ਉਹਦੇ ਨਾ ਬਾਕੀ ਸਬਜੈਕਟਸ 'ਚ ਤਾਂ ਠੀਕ ਨੇ ਮਿਨਸ ਨ ਦੇ ਸੱਤਰ ਕੁ ਤੋਂ ਉੱਪਰ ਹੀ ਨੇ ਸਾਰਿਆਂ 'ਚੋਂ ਇੱਕ ਮੈਥ 'ਚ ਬਹੁਤ ਘੱਟ ਮਾਕਸ ਨੇ ਉਹਦੇ ਜਿਵੇਂ ਫਿਫਟੀ ਫਾਈਵ ਹੀ ਆਏ ਹੈ ਉਹਦੇ ਮੈਥ 'ਚ ਨਹੀਂ ਜੀ ਮੈਂ ਨਾ ਇਹਨੂੰ ਇਹਨੂੰ ਮੇਨ ਪ੍ਰੋਬਲਮ ਹੀ ਐਵੇਂ ਹੈ ਨਾ ਵੀ ਜਿਵੇਂ ਮੈਂ ਵੀ ਜਿ ਦੇਖਿਆ ਇਹਦੇ ਹੁਣ ਇਹਦੇ ਇਗਜਾਮ ਨੂੰ ਪ੍ਰੋਪਰ ਨ ਮਤਲਬ ਚੈੱਕ ਕੀਤਾ ਇਹਦਾ ਇਹਨੂੰ ਨਾ ਜਿਵੇਂ ਬੇਸਿਕ ਚੀਜ਼ਾਂ ਹੀ ਨਹੀਂ ਕਲੈਰੀਫਾਈ ਕਰ ਪਾ ਰਿਹਾ ਇਹ ਤਾਂ ਤੁਸੀਂ ਨਾ ਜਿਵੇਂ ਕੋਈ ਵੀ ਸਮਾਨ ਲੈ ਕੇ ਆਉਣਾ ਹੁੰਦਾ ਹੈ ਜਿਵੇਂ ਬੇਸਿਕ ਯੂਨਿਟ ਤਾਂ ਆਪਾਂ ਜਿਵੇਂ ਘਰ 'ਚ ਜਿਹੜੀਆਂ ਚੀਜ਼ਾਂ ਵਰਤਦੇ ਹਾਂ ਹੈ ਨਾ ਉਹਨਾਂ ਤੋਂ ਹੀ ਕਲੀਅਰ ਹੁੰਦੀਆਂ ਹੁੰਦੀਆਂ ਨੇ ਬੱਚੇ ਨੂੰ ਹੈ ਨਾ ਤਾਂ ਜਿਵੇਂ ਵੀ ਕਦੇ ਸ਼ੌਪ 'ਤੇ ਭੇਜਣਾ ਹੈ ਤਾਂ ਇਹਨੂੰ ਭੇਜਿਆ ਕਰੋ ਵੀ ਇਹਨੂੰ ਪਤਾ ਲੱਗੇ ਵੀ ਕਿੰਨੇ ਦਿੱਤੇ ਹੈ ਅਤੇ ਕਿੰਨੇ ਮੋੜੇ ਹੈ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਫਿਰ ਬੱਚੇ ਨੂੰ ਕੋਨਫੀਡੈਂਸ ਵੀ ਆਉਂਦਾ ਹੈ ਹਿਸਾਬ ਕਿਤਾਬ ਦਾ ਵੀ ਸਮਝ ਆਉਂਦਾ ਉਹਨੂੰ ਫਿਰ ਬੇਸਿਕ ਚੀਜ਼ਾਂ ਅਗਰ ਪਰੋਪਰ ਕਲੀਅਰ ਹੋਣਗੀਆਂ ਬੱਚਿਆਂ ਨੂੰ ਫਿਰ ਮੈਥ ਤਾਂ ਖੁਦ ਮਾ ਖੁਦ ਆਪੇ ਹੀ ਉਹ ਹੋਵੇਗਾ ਨਾ ਵਧੀਆ ਢੰਗ ਨਾਲ ਉਹ ਹੋਵੇਗਾ ਨਹੀਂ ਐਕਚ ਨਹੀਂ ਟਿਊਸ਼ਨ ਨਾਲ ਨਹੀਂ ਨਾ ਕੁਛ ਹੁੰਦਾ ਜਿਹੜੀਆਂ ਚੀਜ਼ਾਂ ਚੱਲੋ ਟਿਊਸ਼ਨ ਵੀ ਨੋ ਡਾਊਟ ਅਗਲਾ ਵੀ ਪੜ੍ਹਾ ਰਿਹਾ ਉਹ ਤਾਂ ਅਸੀਂ ਸਕੂਲ 'ਚ ਵੀ ਕਰ ਹੀ ਰਹੇ ਹਾਂ ਇਨ੍ਹਾਂ ਨੂੰ ਪੜ੍ਹਾ ਹੀ ਰਹੇ ਹਾਂ ਬਸ ਗੱਲ ਇੰਨੀ ਹੈ ਨਾ ਵੀ ਜੇ ਬੇਸਿਕ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿਉਂਕਿ ਹੁਣ ਦੇਖੋ ਅਸੀਂ ਪੜ੍ਹਾ ਰਹੇ ਹਾਂ ਸਕੂਲ 'ਚ ਅਸੀਂ ਕਰ ਰਹੇ ਹਾਂ ਪਰ ਉਹਦਾ ਉਹ ਨਹੀਂ ਹੁੰਦਾ ਨਾ ਵੀ ਉ ਪਰੋਪਰ ਉਹਨੂੰ ਉ ਜਿਵੇਂ ਕੀ ਕਹਿੰਦੇ ਹੁੰਦੇ ਰੁੰਟੀਨ ਵਾਲੀ ਲਾਈਫ਼ ਦੀਆਂ ਚੀਜ਼ਾਂ ਨਹੀਂ ਅਸੀਂ ਐਵੇਂ ਸਿਖਾ ਸਕਦੇ ਨਾ ਉਹ ਤਾਂ ਬੱਚੇ ਨੂੰ ਖੁਦ ਨੂੰ ਖੁਦ ਆਉਂਦੀਆਂ ਨੇ ਬਾਕੀ ਮੀਟਿੰਗ ਹੋਣੀ ਹੈ ਅਤੇ ਫਿਰ ਨਾ ਤੁਸੀਂ ਆ ਜਿਓ ਅਤੇ ਆਪਾਂ ਬੈਠ ਕੇ ਗੱਲ ਕਰਦੇ ਹਾਂ ਨਾਲੇ ਤੁਹਾਨੂੰ ਇਹਦੇ ਇਗਜਾਮ ਦਾ ਬਾਕੀ ਹੋਰ ਵੀ ਦੱਸ ਦੇਵਾਂਗੇ ਠੀਕ ਹੈ ਤੁਸੀਂ ਆ ਜਿਓ ਠੀਕ ਹੈ